ਤਕਨੀਕੀ ਜਿਹੜੀ ਸਹਾਇਤਾ ਪ੍ਰਣਾਲੀ ਹੈਗੀ ਹੈ ਨਾ ਜਿੱਥੋਂ ਆਪਾਂ ਵੱਡੇ ਉਹਦੀ ਗੱਲ ਕਰੀਏ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਓਥੇ ਕੋਈ ਵੀ ਸਮੱਸਿਆ ਨਹੀਂ ਆਉਂਦੀ ਹੈਗੀ ਆਪਾਂ ਨੂੰ ਅਤੇ ਜੇ ਹੁਣ ਆਮ ਲੋਕਾਂ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਮੰਨ ਲਓ ਹੈ ਨਾ ਵੀ ਆਪਣੇ ਜਿਵੇਂ ਬਿਜਲੀ ਦੀ ਆਪਾਂ ਉਹ ਕਰਨੀ ਆ ਆਪਣੀ ਲਾਈਟ ਚਲੀ ਗਈ ਹੈ ਨਾ ਬਿਜਲੀ ਚਲੀ ਗਈ ਆਪਾਂ ਵੀ ਓਥੇ ਇੱਕ ਦ ਉਹ ਦੇਣੀ ਹੈਗੀ ਉਨ੍ਹਾਂ ਨੂੰ ਇੱਕ ਉਹ ਕਰਨੀ ਹੈਗੀ ਸ਼ਿਕਾਇਤ ਕਰਨੀ ਹੈਗੀ ਵੀ ਸਾਡੇ ਇੰਨੇ ਟੈਮ ਤੋਂ ਵਈ ਕੱਟ ਲੱਗਿਆ ਹੋਇਆ ਹੈਗਾ ਵਈ ਕਦੋਂ ਆਊਗੀ ਲੈਟ ਹੈ ਨਾ ਵੀ ਸਾਨੂੰ ਪਾਣੀ ਦੀ ਸਮੱਸਿਆ ਹੋ ਰਹੀ ਹੈ ਵੀ ਸ ਹੁਣ ਪਤਾ ਹੀ ਹੈ ਬਿਜਲੀ ਕਰਕੇ ਸਾਰੇ ਕੰਮ ਠੱਪ ਹੋ ਜਾਂਦੇ ਹੈ ਆਪਾਂ ਨੂੰ ਹੈ ਨਾ ਤਾਂ ਮਤਲਬ ਕੀ ਹੈਗਾ ਵੀ ਜੇ ਆਪਾਂ ਤਕਨੀਕੀ ਸਿੱਖਿਆ ਤਕਨੀਕੀ ਸਿੱਖਿਆ ਦੀ ਗੱਲ ਕਰੀਏ ਜੇ ਆਪਾਂ ਔਨਲਾਈਨ ਹੈ ਨਾ ਵੀ ਅਪਲਾਈ ਕਰਦੇ ਹੈਗੇ ਔਨਲਾਈਨ ਜੇ ਆਪਾਂ ਉਨ੍ਹਾਂ ਨੂੰ ਕਹਿੰਦੇ ਹੈਗੇ ਤਾਂ ਕਈ ਵਾਰੀ ਕੀ ਉਹ ਫੋਨ ਨਹੀਂ ਚੱਕਦੇ ਹੈਗੇ ਹੈ ਨਾ ਤਾਂ ਆਪਾਂ ਨੂੰ ਕੀ ਹੈ ਮਤਲਬ ਬਹੁਤ ਸਾਰੀਆਂ ਐਵੇਂ ਸਮੱਸਿਆਵਾਂ ਆਉਂਦੀਆਂ ਨੇ ਵੀ ਸਰਕਾਰ ਨੇ ਕੀ ਹੈਗਾ ਵੀ ਔਫਲਾਈਨ ਦੇ ਨਾਲ ਨਾਲ ਔਨਲਾਈਨ ਸਾਰਾ ਕੁਛ ਸ਼ੁਰੂ ਤਾਂ ਕਰਤਾ ਪਰ ਕਿਤੇ ਨਾ ਕਿਤੇ ਮਤਲਬ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਫਿਰ ਵੀ ਇੱਕ ਆਮ ਬੰਦਾ ਹੈਗਾ ਨਾ ਜੇ ਉਹ ਕਰ ਵੀ ਦਿੰਦਾ ਘਰ ਬੈਠੇ ਫੋਨ ਅਤੇ ਕਈ ਵਰੀ ਉਹ ਫੋਨ ਨਹੀਂ ਚੱਕਦੇ ਹੈਗੇ ਫਿਰ ਵੀ ਉਹਨੂੰ ਥੱਕ ਹਾਰ ਕੇ ਉਹਨੂੰ ਥ ਫਿਰ ਓਥੇ ਪਤਾ ਨਹੀਂ ਕਿੱਡੀ ਦੂਰ ਮਤਲਬ ਕਿ ਉਹ ਕਿੱਥੇ ਬੈਠਾ ਹੁੰਦਾ ਅਤੇ ਕਿੱਥੇ ਹੁਣ ਇਹ ਬਣਿਆ ਹੁੰਦਾ ਸ਼ਿਕਾਇਤ ਕੇਂਦਰ ਹੈ ਨਾ ਓਥੇ ਜਾ ਕੇ ਉਹਨੂੰ ਕੀ ਹੈ ਆਪਦੀ ਸ਼ਿਕਾਇਤ ਦਰਜ ਕਰਾਉਣੀ ਪੈਂਦੀ ਹੈ ਫਿਰ ਕਿਤੇ ਜਾ ਕੇ ਇੱਕ ਦੋ ਦਿਨਾਂ 'ਚ ਉਹਦਾ ਹੱਲ ਹੁੰਦਾ ਹੈਗਾ ਤਾਂ ਮਤਲਬ ਕਿ ਇਹ ਚੀਜ਼ਾਂ ਮਤਲਬ ਕੀ ਹੈ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਆਮ ਨੇ ਦੇਖਣ ਨੂੰ ਹੈ ਨਾ ਵੀ ਇਹ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਨੇ ਵੱਡੇ ਪੱਧਰ 'ਤੇ ਤਾਂ ਇਹ ਚੀਜ਼ਾਂ ਮਤਲਬ ਕਿ ਜਿਹੜੇ ਬੰਦੇ ਨੂੰ ਹੁਣ ਜਾਣਕਾਰੀ ਹੈ ਪੜ੍ਹਿਆ ਲਿਖਿਆ ਬੰਦਾ ਉਹ ਅਰਾਮ ਨਾਲ ਉਹਨੂੰ ਕੋਈ ਸਮੱਸਿਆ ਨਹੀਂ ਆਉਂਦੀ ਇਸ ਤਰੀਕੇ ਦੀ